ਕੀ ਤੁਸੀਂ ਕੋਈ ਬਾਇਓਗੈਸ ਪਲਾਂਟ ਦੇਖਿਆ ਹੈ ਇਹ ਲੋਕਾਂ ਦੀ ਮਦਦ ਕਿਵੇਂ ਕਰਦਾ ਹੈ ਬਾਇਓਗੈਸ ਗੋਬਰ ਹੁੰਦਾ ਤਾ ਅਤੇ ਪਹਿਲਾਂ ਟੋਆ ਪੱਟ ਦਿੰਦੇ ਤੇ ਟੋਏ ਦੇ ਵਿੱਚ ਉਹ ਤੋਂ ਬਾਅਦ ਫਿਰ ਟੋਆ ਪੱਟ ਕੇ ਉਹਦੇ ਵਿੱਚ ਉਹਦੇ 'ਤੇ ਮਸ਼ੀਨਾਂ ਲਾ ਕੇ ਉਹ ਅਤੇ ਉਹਦੇ ਵਿੱਚ ਗੋਹਾ ਗੇਰ ਦਿੰਦੇ ਤੇ ਅਤੇ ਗੋਹੇ ਦੇ ਵਿੱਚ ਬਾਅਦ ਪੈਪ ਲਾ ਦਿੰਦੇ ਤੇ ਅਤੇ ਪੈਪ ਲਾ ਕੇ ਉਹਦੇ ਦੋ ਕੁ ਓਧਰੋਂ ਗੈ ਗੈਸ ਛੱਡ ਦਿੰਦੇ ਤੇ ਉਹ ਆਪਣਾ ਉਹ ਬਣ ਜਾਂਦਾ ਤਾ ਅਤੇ ਬਾਇਓਗੈਸ ਲਾ ਕੇ ਲੋਕਾਂ ਲੋਕ ਦੀ ਮਦਦ ਕਿਵੇਂ ਕਰਦਾ ਸੀ ਅਤੇ ਲੋਕਾਂ ਨੂੰ ਆਪਣੇ ਚੁੱਲ੍ਹੇ ਚਾਲੇ ਬਾਲ ਲੈਂਦੇ ਤੇ ਉਸ ਨਾਲ ਅਤੇ ਚੁੱਲ੍ਹਾ ਪਾਥੀਆਂ ਪਾਥੀਆਂ ਬਚ ਜਾਂਦੀਆਂ ਤੀਆਂ ਅਤੇ ਪਾਥੀਆਂ ਬਚਣ ਕਰਕੇ ਆਪਣਾ ਜਿਹੜਾ ਉਹ ਲੱਕੜ ਬਾਲਣ ਹੁੰਦਾ ਹੈ ਬਾਲਣ ਪਿੰਡਾਂ ਦੇ ਵਿੱਚ ਉਹ ਬਚ ਜਾਂਦਾ ਤਾ ਅਤੇ ਗੈਸ ਗੈਸ ਜਿਹੜੀ ਹੁੰਦੀ ਤੀ ਬਾਇਓਗੈਸ ਅਤੇ ਉਹਦੇ ਉਪਰ ਰੋਟੀ ਪਾਣੀ ਅਤੇ ਦਾਲ ਸਬਜ਼ੀ ਜੋ ਵੀ ਹੁੰਦਾ ਤਾ ਘਰ ਦਾ ਕੰਮ ਅਤੇ ਦੁ ਦੁੱਧ ਗਰਮ ਕਰ ਦੇਣਾ ਉਹਦੇ ਉਹਦੇ ਉੱਪਰ ਚੁੱਲ੍ਹੇ ਦੇ ਉੱਪਰ ਅਤੇ ਦੁੱਧ ਗਰਮ ਕਰਕੇ ਅਤੇ ਆਪਣਾ ਫਿਰ ਚਾਹ ਬਣਾ ਲੈਣੀ ਚਾ ਚਾਹ ਬਣ ਜਾਣੀ ਫਿਰ ਪਾਣੀ ਪੂਣੀ ਗਰਮ ਕਰ ਲੈਣਾ ਅਤੇ ਇਕਣੇ ਬਾਇਓਗੈਸ ਦਾ ਸਾਨੂੰ ਬਹੁਤ ਫਾਇਦਾ ਵੀ ਹੁੰਦਾ ਤਾ